ਮੈਨੂੰ ਲੜਾਈ ਝਗੜੇ ਵਾਲੀਆਂ ਫਿਲਮਾਂ ਵੇਖਣਾ ਬਹੁਤ ਹੀ ਪਸੰਦ ਹਨ ਜ਼ਿਆਦਾਤਰ ਇਹੋ ਜਿਹੀਆਂ ਫਿਲਮਾਂ ਸਾਊਥ ਵਿੱਚ ਮਿਲਦੀਆਂ ਹਨ ਮਿਲਦੀਆਂ ਤਾਂ ਸ ਅ ਇੰਡੀਅਨ ਵਿੱਚ ਵੀ ਇਸ ਇੰਡੀਆ ਵਿੱਚ ਕਾਫੀ ਪ੍ਰਕਾਰ ਦੀਆਂ ਫਿਲਮਾਂ ਹਨ ਪਰ ਮੈਨੂੰ ਸਾਊਥ ਦੀਆਂ ਫਿਲਮਾਂ ਜ਼ਿਆਦਾ ਵੇਖਣੀਆਂ ਤਾਂ ਕਰਕੇ ਪਸੰਦ ਕਿਉਂਕਿ ਉਹਦੇ ਵਿੱਚ ਲੜਾਈ ਅਤੇ ਬਹੁਤ ਹੀ ਕੂਟ ਕੂਟ ਕੇ ਭਰੀ ਹੁੰਦੀ ਹੈ ਲੜਾਈਆਂ ਵੀ ਨ ਲੜਾਈਆਂ ਵੀ ਨੋਰਮਲ ਕਿਸਮ ਦੀਆਂ ਨਹੀਂ ਹੁੰਦੀਆਂ ਹਨ ਉਹਦੇ ਵਿੱਚ ਜਿਹੜਾ ਟਰਿਕਸ ਵਰਤੀਆਂ ਜਾਂਦੀਆਂ ਹਨ ਅਤੇ ਯੂਨੀਕ ਤਰੀਕੇ ਦੀਆਂ ਟ ਅ ਤਾੜ ਫਾੜ ਵਰਤੀ ਜਾਂਦੀ ਆ ਉਹ ਬਹੁਤ ਹੀ ਵਧੀਆ ਲੱਗਦੀ ਹੈ ਮੈਂ ਅ ਸਾਊਥ ਦੇ ਕਾਫੀ ਸਾਰੇ ਐਕਟਰਾਂ ਨੂੰ ਵੇਖਦਾ ਹਾਂ ਐਕਟਿੰਗ ਕਰਦੇ ਹੋਏ ਜੇਕ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹਨ ਸੋਲਜਰ ਫਿਲਮ ਕੇ ਜੀ ਐੱਫ ਫਿਲਮ ਬਾਹੂਬਲੀ ਫਿਲਮ ਇਹ ਤਿੰਨ ਮੇਰੀਆਂ ਮਸੰਦ ਪਸੰਦੀਦਾ ਫਿਲਮਾਂ ਹਨ ਜੋ ਕਿ ਮੈਂ ਇੱਕ ਵਾਰ ਨਾ ਹੀ ਬਹੁਤ ਬਹੁਤ ਵਾਰ ਦੇਖਣਾ ਪਸੰਦ ਕਰਦਾ ਹਾਂ ਬਾਹੂਬਲੀ ਦੀ ਸਟੋਰੀ ਬਹੁਤ ਹੀ ਪਸੰਦ ਹੈ ਜਿਹਦੇ ਵਿੱਚ ਇੱਕ ਰਿਆਸਤ ਬਾਰੇ ਦੱਸਿਆ ਜਾਂਦਾ ਹੈ ਜਿਹਦੇ ਵਿੱਚ ਇੱਕ ਰਿਆਸਤ ਦਾ ਰਾਜਾ ਹੁੰਦਾ ਹੈ ਜੋ ਕਿ ਆਪਣੀ ਮਾਂ ਨੂੰ ਅ ਪਸੰਦ ਅ ਪ੍ਰਸੰਨਤਾ ਲਈ ਬਾਹਰ ਆਪਣੀ ਰਿਆਸਤ ਦੇ ਸਾਰੇ ਬੰਦਿਆਂ ਨੂੰ ਵੇਖਣ ਲਈ ਚਲਾ ਜਾਂਦਾ ਹੈ ਅਤੇ ਪਿੱਠ ਪਿੱਛੋਂ ਉਸ ਦਾ ਭਰਾ ਸਾਰੀ ਰਿਆਸਤ ਹੜੱਪਣ ਲਈ ਆਪਣੀ ਮਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ ਅਤੇ ਅਗਰ ਗੱਲ ਕੀਤੀ ਜਾਏ ਕੇ ਜੀ ਐੱਫ ਦੀ ਕੇ ਜੀ ਐੱਫ 'ਚ ਜਿਹੜੀ ਸਟੋਰੀ ਹੈ ਉਹ ਇੱਕ ਖਾ ਉਹ ਇੱਕ ਗੋਲਡ ਦੀ ਤਸਕਰੀ ਨੂੰ ਲੈ ਕੇ ਕੀਤੀ ਗਈ ਹੈ ਜੋ ਕਿ ਇੱਕ ਬੰਦਾ ਸਾਰੇ ਅ ਦੇਸ਼ ਦਾ ਸੋਨਾ ਆਪਣੇ ਅੰਡਰ ਕਰ ਲੈ ਕਾਬੂ ਕਰ ਲੈਣਾ ਚਾਹੁੰਦਾ ਹੈ ਅਤੇ ਉਹਦੇ ਵਿੱਚ ਮਾਰ ਧਾੜ ਵੀ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਇੱਕ ਬੰਦਾ ਸੌ ਸੌ ਬੰਦਿਆਂ ਉੱਤੇ ਭਾਰੀ ਪੈ ਜਾਂਦਾ ਹੈ ਮੈਂ ਇਸ ਤਰ੍ਹਾਂ ਦੀਆਂ ਫਿਲਮਾਂ ਵੇਖਣਾ ਬਹੁਤ ਹੀ ਪਸੰਦ ਕਰਦਾ ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਰਿਤਿਕ ਰੋਸ਼ਨ ਦੀਆਂ ਵੀ ਬੜੀਆਂ ਹੀ ਆਉਂਦੀਆਂ ਹਨ ਜਿਹੜੀ ਕਿ ਹੁਣੇ ਵੀ ਇੱਕ ਫਿਲਮ ਪੋਸਟਮੈਨ ਰਿਲੀਜ਼ ਹੋਈ ਆ ਜਿਹਦੇ ਵਿੱਚ ਲੜਾਈ ਝਗੜਾ ਵੀ ਬਹੁਤ ਹੀ ਜ਼ਿਆਦਾ ਭਰਿਆ ਹੈ ਫਿਲਮਾਂ ਤਾਂ ਹੋਰ ਵੀ ਤਰੇ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹਨ ਪਰ ਮੈਨੂੰ ਲੜਾਈ ਝਗੜੇ ਵਾਲੀਆਂ ਫਿਲਮਾਂ ਜਦ ਕੁਝ ਜ਼ਿਆਦਾ ਹੀ ਪਸੰਦ ਹਨ ਅਤੇ ਮੈਂ ਉਹੀ ਵੇਖਣਾ ਜ਼ਿਆਦਾ ਪਸੰਦ ਕਰਦਾ ਹਾਂ